ਭਾਰਤ ਵਿੱਚ ਬਹੁਤ ਹੀ ਪ੍ਰਸਿੱਧ ਵਿਗਿਆਨੀ ਆ ਉਹਨਾਂ ਦੇ ਵਿੱਚੋਂ ਇੱਕ ਏ ਪੀ ਜੀ ਅਬਦੁਲ ਕਲਾਮ ਆ ਜਿਹੜੇ ਕਿ ਮੈਨੂੰ ਬਹੁਤ ਹੀ ਪਸੰਦ ਆ ਉਹਨਾਂ ਨੇ ਕੀ ਕੀਤਾ ਸੀਗਾ ਕਿ ਸੈਟੀਲਾਈਟ ਦੇ ਬੇਸਿਸ 'ਤੇ ਕੁਝ ਰਿਸਰਚ ਕੀਤੀਆਂ ਸੀਗੀਆਂ ਅਤੇ ਉਹ ਮੈਨੂੰ ਪਸੰਦ ਤਾਂ ਵਾ ਕਿ ਉਹ ਇੱਕ ਸਾਇੰਟਿਸਟ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਮੋਟੀਵੇਟਰ ਵੀ ਆ ਉਹ ਕੀ ਕਰਦੇ ਆ ਜੋ ਸਟੂਡੈਂਟਸ ਹੈਗੇ ਜੋ ਅੱਜ ਦਾ ਯੂਥ ਹੈਗਾ ਵਾ ਉਹਨਾਂ ਨੂੰ ਕੀ ਕਰਦੇ ਸੀਗੇ ਕਿ ਮੋਟੀਵੇਟ ਬਹੁਤ ਕਰਦੇ ਸੀਗੇ ਉਹਨਾਂ ਦਾ ਥੋਟਸ ਵਾ ਉਹ ਅੱਜ ਵੀ ਜਿਹੜੇ ਆ ਉਹ ਬੱਚੇ ਸੁਣਦੇ ਆ ਅਤੇ ਉਹਨਾਂ ਤੋਂ ਕੁਝ ਨਾ ਕੁਝ ਜਿਹੜਾ ਵਾ ਉਹ ਸਮਝਦੇ ਆ ਜਾਂ ਇੰਸਪਾਇਰ ਹੁੰਦੇ ਹਨ ਉਹਨਾਂ ਦੇ ਥੋਟਸ ਤੋਂ ਉਹਨਾਂ ਦਾ ਨੇਚਰ ਬਹੁਤ ਹੀ ਵਧੀਆ ਵਾ ਉਹ ਬੱਚਿਆਂ ਨਾਲ ਬਿਲਕੁਲ ਫਰੈਂਕ ਸੀਗੇ ਅਤੇ ਉਹ ਬਹੁਤ ਹੀ ਵਧੀਆ ਸੀ ਇਸ ਕਰਕੇ ਮੈ ਮੈਨੂੰ ਜਿਹੜੇ ਆ ਉਹ ਬਹੁਤ ਹੀ ਪਸੰਦ ਆ